ਭਾਰਤੀ ਵਿੱਚ ਬਹੁਤ ਸਾਰੇ ਧਾਰਮਿਕ ਅਸਥਾਨ ਹਨ ਜਿਹਨਾਂ ਵਿੱਚ ਸ਼੍ਰੀ ਨੈਣਾ ਦੇਵੀ ਸ਼੍ਰੀ ਮਨਸਾ ਦੇਵੀ ਸ਼੍ਰੀ ਅਨੰਦਪੁਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸ਼੍ਰੀ ਚਮਕੌਰ ਸਾਹਿਬ ਅਤੇ ਸ਼੍ਰੀ ਫਤਿਹਗੜ ਸਾਹਿਬ ਮ ਮੁੱਖ ਹਨ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜੋ ਅੱਜ ਕੱਲ੍ਹ ਵਿਸਾਖੀ ਦਾ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਅੰਬਰਸਰ ਸ਼੍ਰੀ ਗੁਰੂ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਜਿੱਥੇ ਅੱਜ ਕੱਲ੍ਹ ਚੌਵੀ ਘੰਟੇ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਅਤੇ ਚਾਲ਼ੀ ਸਿੰਘ ਹੋਰ ਸ਼ਹੀਦ ਹੋਏ ਜਿੱਥੇ ਸ਼੍ਰੀ ਗੁ ਗੁਰੂ ਗੋਬਿੰਦ ਸਿੰਘ ਤਾੜੀ ਮਾਰ ਕੇ ਚਮਕੌਰ ਸਾਹਿਬ ਤੋਂ ਗਏ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਤਾੜੀ ਸਾਹਿਬ ਹੈ ਫਤਿਹਗੜ੍ਹ ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪਾਈ ਜਿੱਥੇ ਉਹ ਟਾਈਮ ਦੀ ਮੁਗਲ ਸਰਕਾਰ ਨੇ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਦੋਂ ਮਾਤਾ ਗੁਜਰੀ ਨੂੰ ਇਸਦਾ ਪਤਾ ਲੱਗਿਆ ਅਤੇ ਉਹਨਾਂ ਨੇ ਠੰਡੇ ਬੁਰਜ ਤੋਂ ਥੱਲੇ ਛਾਲ ਮਾਰ ਤੀ ਅਤੇ ਆਪਣੀ ਸ਼ਹਾਦਤ ਦਾ ਜਾਮ ਪੀ ਗਏ ਅਤੇ ਜਿੱਥੇ ਮਾਤਾ ਜੀ ਅਤੇ ਬੱਚਿਆਂ ਦੇ ਗੁਰੂ ਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਬਹੁਤ ਦੁੱਧ ਪਿਲਾਉਣ ਦੀ ਸੇਵਾ ਲਾਈ ਮੋਤੀ ਮਹਿਰਾ ਜੀ ਨੇ ਮੋਤੀ ਮਹਿਰਾ ਜੀ ਨੇ ਲਾਈ ਅਤੇ ਉਹਨਾਂ ਦਾ ਵੀ ਉਹਨਾਂ ਨੇ ਬੜੀ ਕੁਰਬਾਨੀ ਕੀਤੀ ਉਹਨਾਂ ਦਾ ਸਾਰਾ ਟੱਬ ਜਿਹੜਾ ਪਰਿਵਾਰ ਆ ਉਹ ਉਸ ਟਾਈਮ ਮੁਗਲ ਸਰਕਾਰ ਨੇ ਕੋਲੂ ਨਾਲ਼ ਪੀੜ ਦਿੱਤਾ ਪਲਾਟ ਦੇ ਵਿੱਚ ਜਦੋਂ ਸੰਸਕਾਰ ਕੀਤਾ ਸਾਹਿਬਜ਼ਾਦਿਆਂ ਅਤੇ ਮਾਤਾ ਦਾ ਉੱਥੇ ਮੁਗਲਾਂ ਨੇ ਰੱਖ ਦਿੱਤਾ ਵੀ ਜੇ ਜਗ੍ਹਾ ਜੇ ਕੋਈ ਮੁੱਲ ਲਵੇਗਾ ਤਾਂ ਸੰਸਕਾਰ ਦੀ ਜਗ੍ਹਾ ਦਿੱਤੀ ਜਾਵੇਗੀ ਜਿੱਥੇ ਟੋਡਰ ਮੱਲ ਜੀ ਨੇ ਟੋਡਰ ਮੱਲ ਜੀ ਨੇ ਮੋਹਰਾਂ ਖੜ੍ਹੀਆਂ ਕਰਕੇ ਉਹ ਜਗ੍ਹਾ ਖਰੀਦੀ ਅਤੇ ਸਾਹਿਬਜ਼ਾਦੇ ਅਤੇ ਮਾਤਾ ਜੀ ਦਾ ਮਾਤਾ ਗੁਜਰੀ ਦਾ ਸੰਸਕਾਰ ਕੀਤਾ ਜੋ ਜਿਹੜੀ ਜਗ੍ਹਾ ਹੈ ਉਹ ਅੱਜ ਕੱਲ੍ਹ ਆਲ ਵਰਲਡ ਨਾਲੋਂ ਵੀ ਮਹਿੰਗੀ ਹੈ